ਛੱਬੀ ਅਗਸਤ ਉੱਨੀ ਸੌ ਅੱਸੀ ਉੱਨੀ ਨਵੰਬਰ ਦੋ ਹਜ਼ਾਰ ਸੱਤ ਵੀਹ ਜਨਵਰੀ ਦੋ ਹਜ਼ਾਰ ਦਸ ਸੱਤ ਮਾਰਚ ਦੋ ਹਜ਼ਾਰ ਵੀਹ ਪੰਦਰਾਂ ਮਈ ਦੋ ਹਜ਼ਾਰ ਬਾਈ